ਮੈਂ ਸਿਲਾਈ ਅਤੇ ਕਢਾਈ ਬਹੁਤ ਹੀ ਵਧੀਆ ਤਰੀਕੇ ਨਾਲ ਕਰਦੀ ਹਾਂ ਮੈਂ ਇੱਕ ਦੁਕਾਨ ਮੈਂ ਆਪਣੀ ਸ਼ਹਿਰ ਵਿੱਚ ਦੁਕਾਨ ਵੀ ਪਾਈ ਹੋਈ ਹੈ ਮੈਂ ਇੱਕ ਟੇਲਰ ਹਾਂ ਅਤੇ ਮੇਰੇ ਕੋਲ ਬਹੁਤ ਹੀ ਜਿਹੜੇ ਆ ਕਸਟਮਰ ਆਉਂਦੇ ਆ ਸਿਲਾਈ ਕਢਾਈ ਜਿਹੜੀ ਆ ਉਹ ਸਿੱਖਣ ਆਉਂਦੇ ਆ ਅਤੇ ਮੈਂ ਹੁਣ ਸਿਲਾਈ ਕਢਾਈ ਦੇ ਨਾਲ ਨਾਲ ਬਿਊਟੀ ਪਾਰਲਰ ਦਾ ਕੰਮ ਵੀ ਜਿਹੜਾ ਆ ਕਰਦੀ ਹਾਂ ਕਈ ਜਿਹੜੇ ਕਸਟਮਰ ਆਉਂਦੇ ਆ ਉਹ ਸਿਲਾਈ ਕਢਾਈ ਦੇ ਨਾਲ ਜਿਹੜੇ ਆ ਉਹ ਆਪਣਾ ਮੇਕਅਪ ਵੀ ਕਰਵਾ ਕੇ ਜਾਂਦੇ ਆ ਅਤੇ ਮੈਂ ਇੰਟਰਸਟ ਬਿਊਟੀ ਪਾਰਲਰ ਵਿੱਚ ਬਹੁਤ ਹੀ ਜ਼ਿਆਦਾ ਇੰਟਰਸਟ ਰੱਖਦੀ ਹਾਂ ਸਿਲਾਈ ਕਢਾਈ ਦੇ ਨਾਲ ਨਾਲ ਮੈਂ ਬਿਊਟੀ ਪਾਰਲਰ ਦਾ ਕੰਮ ਵੀ ਕਰਦੀ ਹਾਂ ਜਿਹੜੇ ਵੀ ਕਸਟਮਰ ਜਿਹੜੇ ਆ ਸੂਟ ਸਿਲਾਣ ਆਉਂਦੇ ਆ ਆਪਣਾ ਕੁਛ ਵੀ ਜਿਹੜੇ ਆ ਸਿਲਵਾਣ ਜਾਂਦੇ ਆ ਸੂਟ ਸਿਲਵਾਣ ਜਾਂਦੇ ਆ ਉਹ ਮੇਰੇ ਕੋਲ ਮੇਕਅਪ ਵੀ ਕਰਵਾ ਕੇ ਜਾਂਦੇ ਆ ਅਤੇ ਮੇਰਾ ਜਿਹੜਾ ਹੈ ਇਹ ਬਿਊਟੀ ਪਾਰਲਰ ਦਾ ਕੰਮ ਅਤੇ ਸਿਲਾਈ ਦੇ ਨਾਲ ਨਾਲ ਬਹੁਤ ਹੀ ਜ਼ਿਆਦਾ ਚੱਲ ਰਿਹਾ ਅਤੇ ਮੈਨੂੰ ਬਿਊਟੀ ਪਾਰਲਰ ਦਾ ਕੰਮ ਬਿਊਟੀ ਪਾਰਲਰ ਦਾ ਕੰਮ ਕਰਨਾ ਬਹੁਤ ਹੀ ਵਧੀਆ ਲੱਗਦਾ ਹੈ ਅਤੇ ਜਿਹੜੇ ਵੀ ਕਸਟਮਰ ਆ ਕੇ ਆਉਂਦੇ ਆ ਉਹ ਬਹੁਤ ਹੀ ਖੁਸ਼ੀ ਨਾਲ ਮੇਕਅਪ ਕਰਵਾ ਕੇ ਜਾਂਦੇ ਆ ਅਤੇ ਅੱਜ ਤੱਕ ਮੈਂ ਇੱਕ ਟੇਲਰ ਦੀ ਦੁਕਾਨ ਖੋਲ੍ਹੀ ਹੋਈ ਏ ਅਤੇ ਉਹਦੇ ਨਾਲ ਨਾਲ ਹੀ ਬਿਊਟੀ ਕਾ ਪਾਰਲਰ ਦਾ ਕੰਮ ਵੀ ਮੈਂ ਖੋਲ੍ਹਿਆ ਹੋਇਆ ਇਹ ਦੋਨਾਂ ਨਾਲ ਜਿਹੜੇ ਆ ਮੈਨੂੰ ਦੋਨਾਂ ਵਿੱਚ ਹੀ ਬਹੁਤ ਜ਼ਿਆਦਾ ਇੰਟਰਸਟ ਹੈ ਅਤੇ ਮੇਰੇ ਕੋਲ ਕਸਟਮਰ ਜਿਹੜੇ ਆ ਉਹ ਵੀ ਬਹੁਤ ਹੀ ਜ਼ਿਆਦਾ ਖੁਸ਼ੀ ਨਾਲ ਮੇਕਅਪ ਵੀ ਕਰਵਾ ਕੇ ਜਾਂਦੇ ਹਨ ਅਤੇ ਆਪਣੇ ਸੂਟ ਵੀ ਸਿਲਵਾ ਕੇ ਜਾਂਦੇ ਹਨ ਮੈਨੂੰ ਵੀ ਇਹਨਾਂ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀ ਮਿਲਦੀ ਹੈ ਅਤੇ ਮੈਂ ਆਪਣੇ ਦੋਨੋਂ ਕੰਮ ਹੀ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੇ ਆ ਉਹ ਕਰਨ ਦੀ ਕੋਸ਼ਿਸ਼ ਇਹਦੇ ਵਿੱਚ ਮੈਨੂੰ ਦੋਨਾਂ ਕੰਮਾਂ ਕਰਨ ਵਿੱਚ ਮੈਨੂੰ ਕੋਈ ਵੀ ਦਿੱਕਤ ਨਹੀਂ ਆਉਂਦੀ ਕਿਉਂਕਿ ਸੂਟ ਸੀਣ ਦੇ ਨਾਲ ਨਾਲ ਹੀ ਮੈਂ ਆਪਣਾ ਇੱਕ ਕਿਉਂਕਿ ਇੰਟਰਸਟ ਮੇਰਾ ਬਿਊਟੀ ਪਾਰਲਰ ਦੇ ਵਿੱਚ ਆ ਅਤੇ ਨਾਲ ਵੀ ਸੂਟ ਸੀਣ ਦੇ ਨਾਲ ਨਾਲ ਵੀ ਟੇਲਰ ਹੋਣ ਦੇ ਨਾਲ ਨਾਲ ਮੈਂ ਬਿਊਟੀ ਪਾਰਲਰ ਦਾ ਕੰਮ ਵੀ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਕਰ ਰਹੀ ਹਾਂ ਅਤੇ ਕਸਟਮਰ ਵੀ ਬਹੁਤ ਜ਼ਿਆਦਾ ਇਹ ਹੈ ਆਉਂਦੇ ਆ